ਹੈਲੋ ਹੈਲੋ ਗੁੱਡ ਈਵਨਿੰਗ ਮੈਮ ਮੈਮ ਆਪ ਮਿਸ਼ੋ ਐਪ ਸੇ ਬਾਤ ਕਰ ਰਹੇ ਹੈ ਮੈਮ ਐਚੁਅਲੀ ਮੇਰਾ ਪਾਰਸਲ ਡਿਲੇ ਹੋ ਗਿਆ ਹੈ ਸੋ ਉਸਕੇ ਰਿਕਾਰਡਿੰਗ ਮੁਝੇ ਆਪਸੇ ਬਾਤ ਕਰਨੀ ਥੀ ਐਚੁਅਲੀ ਮੇਰੇ ਕੋ ਅਰਜੈਂਟ ਚਾਹੀਏ ਥਾ ਮੈਮ ਏਕ ਦੋ ਮੈਮ ਮੇਰਾ ਨਾਮ ਕਸ਼ੀਸ਼ ਹੈ ਉਸ ਨੇਮ ਸੇ ਪਾਰਸਲ ਮੈਨੇ ਕਰ ਰਖੇ ਥੇ ਕਾਫੀ ਸਾਰੇ ਓਰਡਰ ਔਰ ਵੋ ਡਿਲੀਵਰਡ ਨਹੀਂ ਹੁਏ ਮੈਮ ਮੈਨੇ ਅਭੀ ਜਸਟ ਥ੍ਰੀ ਫੋਰ ਡੇਜ਼ ਹੀ ਹੁਏ ਹੈਂ ਉਸਸੇ ਪਹਿਲੇ ਹੀ ਕਿਏ ਹੈ ਮੈਮ ਏਕ ਤੋਂ ਮੈਨੇ ਫਲੋਰਸ ਮੰਗਵਾਏ ਥੇ ਕਰੋਕਰੀ ਕਾ ਕੁਛ ਸਮਾਨ ਥਾ ਪਲੀਜ਼ ਆਪ ਦੇਖੀਏ ਯੈਸ ਮੈਮ ਆਪ ਪਲੀਜ਼ ਟਰਾਏ ਕੀਜੀਏ ਐਚੁਅਲੀ ਮੁਝੇ ਅਰਜੈਂਟਲੀ ਚਾਹੀਏ ਤਬ ਬੀਕੋਸ ਫੈਸਟੀਵਲਸ ਵੀ ਆ ਰਹੇ ਐ ਔਰ ਕੀ ਏ ਔਰ ਕੱਪੜੇ ਵਗੈਰਾ ਵੀ ਮੰਗਵਾਏ ਥੇ ਔਰ ਕਰੋਕਰੀ ਕਾ ਸਮਾਨ ਵੀ ਥਾ ਤੋਂ ਆਪ ਪਲੀਜ਼ ਜਲਦੀ ਕੀਜੀਏਗਾ ਹਾਂਜੀ ਮੈਮ ਪਲੀਜ਼ ਆਪ ਟਰਾਏ ਕੀਜੀਏਗਾ ਵੀਕੋਸ ਮੇਰੇ ਕੋ ਅਰਜੈਂਟਲੀ ਥਾ ਔਰ ਫੈਸਟੀਵਲ ਵੀ ਆਪਕੋ ਪਤਾ ਈ ਐ ਤੋ ਮੁਝੇ ਚਾਹੀਏ ਥਾ ਸਾਰਾ ਸਮਾਨ ਵੀਕੋਸ ਸਬ ਮੈਨੇਜ ਵੀ ਕਰਨਾ ਥਾ ਤੋਂ ਪਲੀਜ਼ ਟਰਾਏ ਕੀਜੀਏ ਕੀ ਜਲਦੀ ਸੇ ਆ ਜਾਏ ਹਾਂਜੀ ਮੈਮ ਪਲੀਜ਼ ਨੋ ਮੈਮ ਔਰ ਕੋਈ ਪ੍ਰੋਬਲਮ ਨਹੀਂ ਹੈ ਐਚੁਅਲੀ ਜੈਸੇ ਮੈਨੇ ਪਹਿਲੇ ਵੀ ਕਾਫੀ ਸਾਰਾ ਸਮਾਨ ਮੰਗਵਾਇਆ ਹੋਇਆ ਐ ਔਰ ਉਹ ਵੀ ਠੀਕ ਠੀਕ ਆਇਆ ਕੋਈ ਪ੍ਰੋਬਲਮ ਨਹੀਂ ਆਈ ਬਟ ਇਸ ਵਾਰ ਪਤਾ ਨਹੀਂ ਕਿਆ ਹੋ ਗਿਆ ਹਾਂਜੀ ਮੈਮ ਤੁਸੀਂ ਪਲੀਜ਼ ਕੋਸ਼ਿਸ਼ ਕਰੋ ਤੇ ਪਲੀਜ਼ ਰਿਕਵੈਸਟ ਪਾਓ

ਓਕੇ ਬਾਏ ਮੈਮ ਓਕੇ ਮੈਮ